ਹੈਲੋ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੈਂ ਆਪਣੇ ਦੋਸਤਾਂ ਅਤੇ ਪਰਿਵਾਰਾਂ ਨਾਲ ਆਪਣਾ ਜਨਮਦਿਨ ਕਿਵੇਂ ਮਨਾਉਂਦਾ ਹਾਂ ਮੈਂ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਆਪਣਾ ਜਨਮ ਦਿਨ ਜਾਂ ਕਿਸੇ ਪ੍ਰਾਪਤੀ ਨੂੰ ਆਪਣੇ ਘਰ ਦੇ ਅੰਦਰ ਹੀ ਰਹਿ ਕੇ ਮਨਾਉਣਾ ਪਸੰਦ ਕਰਦਾ ਹਾਂ ਵੱਡੇ ਪੱਧਰ ਉੱਤੇ ਪੈਸੇ ਦਾ ਜ਼ਿਆਦਾ ਖਰਚਾ ਕਰਨਾ ਮੈਨੂੰ ਪਸੰਦ ਨਹੀਂ ਹੈ ਮੈਂ ਆਪਣੇ ਘਰ ਦੇ ਵਿੱਚ ਹੀ ਸਜਾਵਟ ਲਈ ਕਾਫੀ ਚੀਜ਼ਾਂ ਲਗਾਉਂਦਾ ਹਾਂ ਅਤੇ ਖਾਣ ਪੀਣ ਦੀ ਵਸਤੂਆਂ ਵੀ ਮੈਂ ਆਪਣੇ ਘਰਦਿਆਂ ਨਾਲ ਮਿਲ ਕੇ ਘਰ ਵਿੱਚ ਬਣਾਉਣੀਆਂ ਪਸੰਦ ਕਰਦਾ ਹਾਂ ਤਾਂ ਓਹ ਸਵਾਦ ਵਿੱਚ ਹੀ ਬਹੁਤ ਵਧੀਆ ਹੁੰਦੀਆਂ ਹਨ ਅਤੇ ਬਣਾਉਟੀ ਚੀਜ਼ਾਂ ਨਾਲੋਂ ਕਈ ਗੁਣਾ ਜ਼ਿਆਦਾ ਵਧੀਆ ਹੁੰਦੀਆਂ ਹਨ ਜੋ ਕਿ ਮੇਰੇ ਪਰਿਵਾਰ ਅਤੇ ਮੇਰੇ ਦੋਸਤਾਂ ਨੂੰ ਪਸੰਦ ਹੁੰਦੀ ਹੈ ਅਤੇ ਆਪਣੇ ਘਰ ਵਿੱਚ ਜਸ਼ਨ ਮਨਾ ਕੇ ਆਪਾਂ ਆਪਣੇ ਦੋਸਤਾਂ ਨਾਲ ਆਪਣੇ ਪਰਿਵਾਰ ਨਾਲ ਬਹੁਤ ਹੀ ਵਧੀਆ ਮੈਮਰੀਜ਼ ਬਣਾ ਸਕਦੇ ਹਾਂ ਤਾਂ ਜੋ ਆਪਾਂ ਨੂੰ ਫਿਊਚਰ ਵਿੱਚ ਆਪਣਾ ਪਿਛਲੇ ਬਾਰੇ ਯਾਦ ਆ ਸਕੇ ਮੇਰੇ ਕੋਲ ਇਹਨਾਂ ਜਸ਼ਨਾਂ ਬਾਰੇ ਸਾਂਝਾ ਕਰਨ ਲਈ ਤਜ਼ਰਬਾ ਹੈ ਜੋ ਕਿ ਹਾਲ ਵਿੱਚ ਹੀ ਹੋਇਆ ਹੈ ਹਾਲ ਹੀ ਚੀ ਮੇਰਾ ਜਨਮ ਦਿਨ ਆਇਆ ਸੀ ਜੋ ਕਿ ਮੈਂ ਆਪਣੇ ਪਰਿਵਾਰ ਅਤੇ ਆਪਣੇ ਦੋਸਤਾਂ ਨਾਲ ਆਪਣੇ ਘਰ ਹੀ ਵਿੱਚ ਹੀ ਮਨਾਇਆ ਸੀ ਅਤੇ ਘਰ ਦੀ ਵਸਤੂਆਂ ਨਾਲ ਹੀ ਮਨਾਇਆ ਸੀ ਘਰ ਨੂੰ ਬਹੁਤ ਹੀ ਸਜਾਇਆ ਸੀ ਅਤੇ ਘਰ ਵਿੱਚ ਖਾਣਾ ਪੀਣਾ ਬਣਾ ਕੇ ਮੈਂ ਆਪਣੇ ਦੋਸਤਾਂ ਨੂੰ ਖਲਾ ਕੇ ਬਹੁਤ ਹੀ ਖੁਸ਼ੀ ਮਨਾਈ ਧੰਨਵਾਦ